ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੀ ਕੀ ਹਾਲ ਚਾਲ ਤੁਹਾਡਾ ਹਾਂਜੀ ਠੀਕ ਹੈ ਤੁਸੀਂ ਪਠਾਨਕੋਟ ਤੋਂ ਬੋਲਦੇ ਪਏ ਹੋ ਨਾ ਮੈਂ ਕਿਹਾ ਤੁਸੀਂ ਪਠਾਨਕੋਟ ਤੋਂ ਬੋਲਦੇ ਪਏ ਅੱਛਾ ਅੱਛਾ ਅਸੀਂ ਨਾ ਪਠਾਨਕੋਟ ਅਡਮਿਸ਼ਨ ਲੈਣੀ ਸੀ ਕਿਹੜਾ ਕੋਲੇਜ ਵਧੀਆ ਹੈ ਹਾਂਜੀ ਹਾਂਜੀ ਹਾਂਜੀ ਅੱਛਾ ਅੱਛਾ ਤੁਸੀਂ ਕਿਹੜੇ ਕੋਲੇਜ 'ਚ ਪੜ੍ਹਦੇ ਹੋ ਅੱਛਾ ਠੀਕ ਹੈ ਤੁਸੀਂ ਤੁਸੀਂ ਕਿਹੜੇ ਕੋਲੇਜ 'ਚ ਹੋ ਅੱਛਾ ਠੀਕ ਹੈ ਉਹ ਕੋਲੇਜ ਚਲੋ ਕੋਈ ਨਹੀਂ ਮੈਂ ਵੀ ਇੱਥੇ ਹੀ ਅਡਮਿਸ਼ਨ ਦਾ ਪਤਾ ਕਰ ਲਾਂਗੀ ਠੀਕ ਹੈ ਜੀ ਸਟੱਡੀ ਸਟੂਡੀ ਕਿੱਦਾਂ ਹੈ ਉੱਥੇ ਅੱਛਾ ਅੱਛਾ ਠੀਕ ਹੈ ਅੱਛਾ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਓਕੇ ਜੀ ਫਿਰ ਓਕੇ ਜੀ